ਸਤਿ ਸ਼੍ਰੀ ਅਕਾਲ ਜ ਪਹਿਲੇ ਫੋਨਾਂ ਦੀ ਜੇ ਮੈਂ ਗੱਲ ਕਰਾਂ ਤੋ ਫ ਜਿਹੜੇ ਮੇਰੇ ਕੋਲ ਜਿਹੜਾ ਪਹਿਲਾ ਫੋਨ ਸੀ ਉਹ ਜੀਓ ਜੀਓ ਦਾ ਫੋਨ ਸੀ ਬਟਨਜ਼ ਵਾਲਾ ਉਹਦੇ ਵਿੱਚ ਅਸੀਂ ਇੱਕ ਸਿੰਪਲ ਕਾਲ ਕਰ ਸਕਦੇ ਸੀ ਅਤੇ ਉਹਦੇ ਵਿੱਚ ਅਸੀਂ ਆਪਣੀ ਇੰਜੋਮੈਂਟ ਲਈ ਅਸੀਂ ਗੇਮ ਖੇਡ ਸਕਦੇ ਪਰ ਜਿਹੜਾ ਹੁਣ ਮੇਰੇ ਕੋਲ ਫੋਨ ਹੈ ਉਹ ਵੀਵੋ ਦਾ ਅਤੇ ਉਹਦੇ ਵਿੱਚ ਅਸੀਂ ਉਹਦੇ ਵਿੱਚ ਅਸੀਂ ਸ਼ੋਪਿੰਗ ਸ਼ੋਪਿੰਗ ਕਰ ਸਕਦੇ ਹਾਂ ਅਤੇ ਉਹਦੇ ਵਿੱਚ ਅਸੀਂ ਪੜ੍ਹ ਵੀ ਸਕਦੇ ਹਾਂ ਯੂਟੀਊਬ 'ਚ ਅਤੇ ਫਿਰ ਅਸੀਂ ਉਹਦੇ 'ਚ ਅਸੀਂ ਵੀਡੀਓ ਕਾਲ ਕਰ ਸਕਦੇ ਹਾਂ ਇੱਕ ਦੂਜੇ ਨਾਲ ਮਤਲਬ ਗੱਲ ਕਰ ਸਕਦੇ ਗੱਲ ਕਰ ਸਕਦੇ ਹਾਂ ਮਤਲਬ ਫੇਸ ਟੂ ਫੇਸ ਅਤੇ ਦੂਸਰਾ ਸਿੰਪਲ ਫੋਨ 'ਚ ਅਸੀਂ ਇੱਕ ਦੂਸਰੇ ਨਾਲ ਮਤਲਬ ਗੱਲ ਨਹੀਂ ਕਰ ਸਕਦੇ ਅਤੇ ਹੁਣ ਜਿਹੜੇ ਸਮਾਰਟ ਫੋਨਜ਼ ਆ ਉਹਦੇ ਵਿੱਚ ਅਸੀਂ ਕੁਛ ਖਰੀਦ ਸਕਦੇ ਹਾਂ ਸ਼ੋਪਿੰਗ ਕਰ ਸਕਦੇ ਹਾਂ ਅਤੇ ਕੁਛ ਘਰ ਬੈਠੇ ਅਸੀਂ ਖਾਣਾ ਮੰਗਵਾ ਸਕਦੇ ਹਾਂ ਫਿਰ ਅਸੀਂ ਕਿਸੇ ਦੀ ਆਪਣਾ ਕੋਈ ਪ੍ਰੋਜੈਕਟ ਬਣਵਾ ਸਕਦੇ ਹਾਂ ਗੂਗਲ ਦੀ ਹੈਪ ਹੈਲਪ ਲੈ ਕੇ ਅਤੇ ਅਸੀਂ ਪੁਰਾਣੇ ਫੋਨ ਦੇ ਵਿੱਚ ਇੱਦਾਂ ਦਾ ਕੁਛ ਵੀ ਨਹੀਂ ਸੀ ਹੁੰਦਾ ਬਟ ਹੁਣ ਵਾਲੇ ਫੋਨ 'ਚ ਤਾਂ ਇੱਦਾਂ ਦਾ ਹੁੰਦਾ ਹੈ